ਹਾਂਜੀ ਸਤਿ ਸ਼੍ਰੀ ਕਾਲ ਭਾਜੀ ਮੈਂ ਰੈਲ ਮਾਜਰੇ ਵਾਲਾ ਮਨੀ ਬੋਲ ਰਿਹਾ ਜੀ ਹਾਂਜੀ ਆਪਾਂ ਨੇ ਇੱਕ ਟੈਕਸੀ ਬੁੱਕ ਕਰੀ ਹੋਈ ਸੀਗੀ ਰੈਲ ਮਾਜਰੇ ਤੋਂ ਅੰਮ੍ਰਿਤਸਰ ਜਾਣਾ ਸੀਗਾ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਸੀਗਾ ਉੱਥੇ ਤੁਹਾਨੂੰ ਦੱਸਿਆ ਵੀ ਸੀਗਾ ਰਸਤੇ ਵਿੱਚ ਅਸੀਂ ਆਪਣੇ ਸ਼ਹੀਦ ਭਗਤ ਸਿੰਘ ਦਾ ਉਹ ਵੀ ਦੇਖਣਾ ਸੀਗਾ ਪਿੰਡ ਵੀ ਦੇਖਣਾ ਸੀਗਾ ਅਤੇ ਖਾਣਾ ਵੀ ਖਾਣਾ ਸੀਗਾ ਉਹ ਅੱਗੇ ਜਾ ਕੇ ਆਪਾਂ ਹਵੇਲੀ ਵਿੱਚ ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਾ ਸੀਗਾ ਦਰਬਾਰ ਸਾਹਿਬ ਤੋਂ ਬਾਅਦ ਆਪਾਂ ਫ਼ਿਰ ਬਾਘਾ ਬੋਰਡਰ ਵੀ ਜਾਣਾ ਸੀਗਾ ਅਤੇ ਉਧਰ ਫੇਰ ਤਰਨ ਤਰਨ ਸਾਹਿਬ ਵੀ ਜਾਣਾ ਸੀਗਾ ਅਤੇ ਵਾਪਸ ਮੁੜਦੇ ਹੋਏ ਜਿਹੜੇ ਸਾਡੇ ਨਾਲ ਬੱਚੇ ਆ ਤਾਂ ਉਹਨਾਂ ਨੇ ਖਾਣਾ ਪੀਣਾ ਹੋਇਆ ਤਾਂ ਰਸਤੇ ਵਿੱਚ ਉਹ ਵੀ ਖਾ ਲੈਣਗੇ ਅਤੇ ਇਸ ਮੇਰਾ ਬੁਕਿੰਗ ਹੋਈ ਹੋਈ ਸੀਗੀ ਇਹਦੀ ਪਰਸੋਂ ਦੀ ਮੈਨੂੰ ਨਾ ਹੁਣ ਐਮਰਜੈਂਸੀ ਨਾ ਆਹਾ ਮੇਰੇ ਇੱਕ ਸਾਢੂ ਦਾ ਫੋਨ ਆਇਆ ਉਹ ਬਿਮਾਰ ਹੋ ਗਿਆ ਉਹਦੇ ਕਰਕੇ ਮੈਨੂੰ ਨਾ ਹੁਣ ਉਧਰ ਉਹਦਾ ਐਡਮਿਟ ਹੈ ਉਹਦੇ ਕੋਲ ਜਾਣਾ ਪੈ ਰਿਹਾ ਹੁਣ ਨਾ ਮੈਨੂੰ ਦੋ ਦਿਨ ਮੇਰੇ ਕੋਲ ਦੋ ਤਿੰਨ ਦਿਨ ਟਾਇਮ ਨਹੀਂ ਮਿਲਣਾ ਅਤੇ ਤਾਂ ਕਰਕੇ ਜਿਹੜੇ ਮੈਂ ਆਹ ਆਪਣੀ ਟੈਕਸੀ ਸੀ ਨਾ ਇਹ ਕੈਂਸਲ ਕਰਵਾਉਣਾ ਚਾਹੁੰਦਾ ਤੁਹਾਨੂੰ ਪਤਾ ਮੈਂ ਫਿਫਟੀ ਪਰਸੈਂਟ ਪੇਮੈਂਟ ਪਹਿਲਾਂ ਕਰਤੀ ਸੀਗੀ ਅਤੇ ਫਿਫਟੀ ਰਹਿ ਗਈ ਸੀਗੀ ਅਤੇ ਜਿਹੜੀ ਮੇਰੀ ਪੇਮੈਂਟ ਸੀਗੀ ਮੈਂ ਚਾਹੁੰਦਾ ਵੀ ਤੁਸੀਂ ਜੇ ਹਲੇ ਫਿਲਹਾਲ ਰਿਫੰਡ ਕਰਦੋ ਤਾਂ ਉਹ ਜਿਹੜੇ ਪੈਸੇ ਨੇ ਮੈਨੂੰ ਇੱਧਰ ਕੰਮ ਆ ਜਾਣਗੇ ਮੇਰੇ ਸਾਢੂ ਦੇ ਹੋਸਪਿਟਲ 'ਚ ਤਾਂ ਉਹਦੇ ਕਰਕੇ ਫ਼ਿਰ ਆ ਜਿਹੜੇ ਪੈਸੇ ਆ ਉਧਰ ਕੰਮ ਆਜੂਂਗੇ ਅਤੇ ਜਿੱਦਾਂ ਵੀ ਹੋ ਅੱਗੇ ਦਾ ਪਲੈਨ ਹੋਇਆ ਮੈਂ ਤੁਹਾਨੂੰ ਦੱਸ ਦੂਂਗਾ ਉਹਦੇ ਹਿਸਾਬ ਨਾਲ ਆਪਾਂ ਟੈਕਸੀ ਬੁੱਕ ਕਰਲਾਂਗੇ ਜੀ ਫ਼ਿਰ ਦੁਬਾਰਾ ਤੋਂ ਤੁਹਾਡੀ ਧੰਨਵਾਦ ਜੀ ਬਹੁਤ ਬਹੁਤ